ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਯਸ਼ ਸਰ ਗੱਲ ਕਰ ਰਹੇ ਹੋ ਕਲਾਈਮਿਕਸ ਕਲੱਬ ਤੋਂ ਸਰ ਐਕਚੁਲੀ ਮੈਂ ਨਾ ਪੁੱਛਣਾ ਚਾਹੁੰਦੀ ਸੀ ਮੇਰਾ ਇਕ ਬੱਚਾ ਹੈ ਉਹਨੂੰ ਜਿਵੇਂ ਹੁਣ ਛੁੱਟੀਆਂ ਆ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਆ ਰਹੀਆ ਨੇ ਤਾਂ ਮੈਂ ਉਹਨੂੰ ਤੁਹਾਡੇ ਕਲੱਬ ਵਿੱਚ ਲਗਾਣਾ ਚਾਹੁੰਦੀ ਸੀ ਮੈਂ ਪੁੱਛਣਾ ਸੀ ਕਿ ਕੀ ਕੀ ਐਕਟੀਵਿਟੀਜ਼ ਨੇ ਤੁਹਾਡੇ ਕੋਲ ਤੁਸੀਂ ਕੀ ਕੀ ਸਿਖਾਂਦੇ ਹੋ ਹਾਂਜੀ ਹਾਂਜੀ ਹਾਂਜੀ ਹਾਂ ਓਕੇ ਅੱਛਾ ਜੀ ਸਰ ਆਲਮੋਸਟ ਵੈਸੇ ਤਾਂ ਮੇਰਾ ਨੌ ਸਾਲ ਦਾ ਬੇਟਾ ਤੇ ਆਲਮੋਸਟ ਉਹਦੇ ਐਮੀ ਲਾਈਕ ਐਕਸਟਰਾ ਐਕਟੀਵਿਟੀਜ਼ ਨੂੰ ਹੀ ਇਨਹੈਂਸ ਵਧੀਆ ਕਰਨ ਦੇ ਲਈ ਤਾਂ ਹੀ ਮੈਂ ਚਾਹੁੰਦੀ ਸੀ ਤੇ ਹੋਰ ਤੁਸੀਂ ਦੱਸ ਸਕਦੇ ਹੋ ਕਿ ਇਸ ਏਜ ਗਰੁਪ ਲਈ ਕੀ ਕੀ ਵਧੀਆ ਹੋ ਸਕਦਾ ਜਿਵੇਂ ਹੋਰ ਕੀ ਕਰਾ ਸਕਦੀ ਆਂ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਤੇ ਸਰ ਜਿਵੇਂ ਡਾਂਸ ਕਲਾਸਿਸ ਦੇ ਵਿੱਚ ਕੋਈ ਜਿਵੇਂ ਸਪੈਸੀਫਿਕ ਭੰਗੜਾ ਹੋ ਗਿਆ ਲਾਈਵ ਕੁਛ ਐਸੀਫਿਕ ਵੀ ਆਉਂਦੇ ਆ ਅੱਛਾ ਜੀ ਤੇ ਪਰ ਡੇ ਦਾ ਕਿੰਨਾ ਤੁਸੀਂ ਮਤਲਬ ਕਿੰਨੇ ਟਾਈਮ ਹੁੰਦਾ ਅੱਛਾ ਜੀ ਠੀਕ ਹੈ ਸਰ ਅੱਛਾ ਜੀ ਅੱਛਾ ਜੀ ਤੇ ਕਿੰਨੇ ਟਾਈਮ ਲਈ ਸਰ ਕਿੰਨਾ ਟਾਈਮ ਹੁੰਦਾ ਮਹੀਨੇ ਦਾ ਕੀ ਹਿਸਾਬ ਹੁੰਦਾ ਕੀ ਮਹੀਨਾ ਹੁੰਦਾ ਇੱਕ ਅੱਛਾ ਜੀ ਦੋ ਦੋ ਘੰਟੇ ਕੀ ਕੀ ਟਾਈਮਿੰਗ ਨੇ ਮੋਰਨਿੰਗ ਅੱਛਾ ਜੀ ਸਾਢੇ ਚਾਰ ਤੋਂ ਸਾਢੇ ਛੇ ਓਕੇ ਤੇ ਹੋਰ ਲਾਈਕ ਰਿਫਰੈਸ਼ਮੈਂਟ ਵਗੈਰਾ ਉਹ ਸਾਰਾ ਕੁਝ ਹਾਂਜੀ ਹਾਂਜੀ ਅੱਛਾ ਜੀ ਤੇ ਜਿਵੇਂ ਤੁਹਾਡੇ ਉਵੇਂ ਕੀ ਹੈ ਇੰਸਟੀਟਿਊਟ ਦਾ ਲਾਈਕ ਕਿੰਨੇ ਕ ਟੀਚਰਸ ਨੇ ਉਹ ਕੀ ਪ੍ਰੋਵਾਈਡ ਕਰਦੇ ਹੋ ਤੁਸੀਂ ਅੱਛਾ ਜੀ ਤੇ ਸਰ ਜਿਵੇਂ ਪੇਂਟਿੰਗ ਵਗੈਰਾ ਡਰਾਇੰਗ ਦਾ ਅਸੀਂ ਕਹਿ ਰਹੇ ਸੀ ਕਿ ਉਹਦੇ ਵਿੱਚ ਕੀ ਕੀ ਆ ਉਹਦੇ ਵਿੱਚ ਚਾਰਜ ਸੇਮ ਨੇ ਅੱਛਾ ਜੀ

ਠੀਕ ਹੈ ਤੇ ਉਹਦਾ ਤੇ ਉਹਦਾ ਐਕਸਪੈਂਸ ਕੀ ਆਉਂਦਾ ਪੇਲ ਡਰਾਇੰਗ ਲਈ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਸਰ ਹਾਂਜੀ ਓਕ ਓਕੇ ਥੈਂਕਯੂ ਸਰ